ਮੇਰੀ ਬਗੀਚੀ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਸੀਂ ਉਗਾਉਂਦੇ ਹਾਂ ਜਿਹਦੇ ਵਿੱਚ ਆਲੇ ਦੁਆਲੇ ਫੁੱਲ ਵੀ ਲਗਾਏ ਹੋਏ ਹਨ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਗੇਂਦਾ ਗੁਲਾਬ ਅਤੇ ਹੋਰ ਵੀ ਕਈ ਕਿਸਮ ਦੇ ਸਜਾਵਟੀ ਬੂਟੇ ਲਗਾਏ ਹੋਏ ਹਨ ਜੇ ਉੱਥੇ ਤਾਂ ਕਿ ਕ ਸਬਜ਼ੀਆਂ ਦੀ ਗੱਲ ਕਰੀਏ ਤਾਂ ਗਰਮੀ ਦੇ ਵਿੱਚ ਅਸੀਂ ਜ਼ਿਆਦਾਤਰ ਸ਼ਿਮਲਾ ਮਿਰਚ ਸਾ ਘਈਆ ਮਿੱਠਾ ਕੱਦੂ ਭਿੰਡੀ ਤੋਰੀ ਰਾਮ ਤੋਰੀ ਫਲੀਆਂ ਕਾਲੀ ਤੋਰੀ ਬੈਂਗਣ ਅਰਬੀ ਆਦਿ ਹੋਰ ਕਈ ਕਿਸਮ ਦੀਆਂ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਨੇ ਉਹ ਉਗਾਉਂਦੇ ਹਾਂ ਅਤੇ ਇਹਨਾਂ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਗਰਮੀ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਦੀ ਲੋੜ ਜ਼ਿਆਦਾ ਪੈਂਦੀ ਹੈ ਬੂਟਿਆਂ ਨੂੰ ਅਤੇ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਗਰਮੀ ਦੇ ਵਿੱਚ ਕਿ ਪਾਣੀ ਜ਼ਿਆਦਾ ਦੇਰ ਨਾ ਖੜ੍ਹ ਸਕੇ ਅਤੇ ਜੇ ਸਿਆਲਾਂ ਦੀ ਗੱਲ ਕਰੀਏ ਤਾਂ ਸਿਆਲਾਂ ਦੇ ਵਿੱਚ ਵੀ ਸਾਡੀ ਬਗੀਚੀ ਦੇ ਵਿੱਚ ਅਸੀਂ ਆਮ ਤੌਰ 'ਤੇ ਜਿਹੜੀਆਂ ਸਬਜ਼ੀਆਂ ਉਗਾਈਆਂ ਉਹਨਾਂ ਦੇ ਵਿੱਚ ਮੂਲੀ ਸ਼ਲਗਮ ਗਾਜਰ ਮਟਰ ਗੋਭੀ ਬੰਦ ਗੋਭੀ ਪਾਲਕ ਧਨੀਆ ਸਰ੍ਹੋਂ ਜਿਮੀਕੰਦ ਹਰੀ ਮਿਰਚਾਂ ਵੀ ਲਾਉਂਦੇ ਹਾਂ ਅਤੇ ਜਿਹੜਾ ਨਦੀਨ ਹੈ ਇਹਨੂੰ ਤਾਂ ਅਸੀਂ ਵੱਧ ਤੋਂ ਵੱਧ ਗੁਡਾਈ ਕਰਕੇ ਸਾਨੂੰ ਕੱਢਣਾ ਚਾਹੀਦਾ ਕੋਈ ਸਪਰੇਅ ਨਹੀਂ ਕਰਨੀ ਚਾਹੀਦੀ ਤਾਂ ਕਿ ਅਸੀਂ ਬਿਮਾਰੀਆਂ ਤੋਂ ਵੀ ਬਚ ਸਕੀਏ ਅਤੇ ਘਰੇਲੂ ਬਗੀਚੀ ਦਾ ਪੂਰਾ ਲਾਭ ਲੈ ਸਕੀਏ